ਅਸੀਂ ਆਪਣੇ ਘਰਾਂ ਵਿੱਚ ਸਫਾਈ ਦੀ ਵਰਤੋਂ ਡੇਲੀ ਰੂਟੀਨ ਵਿੱਚ ਕਰਦੇ ਹਾਂ ਜਿਵੇਂ ਕਿ ਫਰਸ਼ਾਂ ਨੂੰ ਧੋਣਾ ਝਾੜੂ ਪੋਚਾ ਕਰਨਾ ਪਰ ਪਹਿਲੇ ਸਮਿਆਂ ਵਿੱਚ ਘਰ ਕੱਚੇ ਹੁੰਦੇ ਸੀ ਇਹਦੇ ਨਾਲ ਗਊ ਡੰਕ ਜਿਹਨੂੰ ਕਿ ਗੋਬਰ ਕਹਿੰਦੇ ਪਹਿਲੇ ਸਮਿਆਂ ਵਿੱਚ ਗਊ ਦਾ ਦੇ ਗੋਬਰ ਨਾਲ ਕੰਧਾਂ 'ਤੇ ਪੋਚੇ ਲਾਏ ਜਾਂਦੇ ਸੀ ਜਾਂ ਕੰਧਾਂ 'ਤੇ ਪੋਚਾ ਮਾਰਿਆ ਜਾਂਦਾ ਸੀ ਜਿਹਦੇ ਨਾਲ ਕਿ ਕਿਰਲੀਆਂ ਕੁਰਲੀਆਂ ਜਾਂ ਜੀਵਾਂ ਤੋਂ ਬਹੁਤ ਘੱਟ ਦੇਖਣ ਨੂੰ ਮਿਲਦੇ ਸੀ ਜਿਵੇਂ ਜਿਵੇਂ ਸਮਾਂ ਚੇਂਜ ਹੁੰਦਾ ਗਿਆ ਉਸ ਦੇ ਨਾਲ ਅੱਜ ਕੱਲ੍ਹ ਪੱਕੇ ਮਕਾਨ ਬਣ ਚੁੱਕੇ ਨੇ ਜਿਹਦੇ ਨਾਲ ਆਪਦੇ ਟਾਈਮ ਵਿੱਚ ਬਹੁਤ ਜੀਵ ਜੰਤੂ ਹੋ ਗਏ ਨੇ ਜਿਹੜਾ ਗਊ ਡੰਕ ਹੈ ਇਹ ਜਿਵੇਂ ਵਿਆਹ ਸ਼ਾਦੀਆਂ ਵਿੱਚ ਵਿਆਹ ਵੇਲੇ ਮੁੰਡੇ ਨੂੰ ਜਿਵੇਂ ਬਟਨਾ ਲਾਇਆ ਜਾਂਦਾ ਹੈ ਉੱਥੇ ਵੀ ਇਸਦੀ ਵਰਤੋਂ ਕੀਤੀ ਜਾਂਦੀ ਹੈ ਇਹ ਬਹੁਤ ਹੀ ਲਾਭਦਾਇਕ ਹੈ ਕਿਉਂਕਿ ਇਹ ਸਾਡੀ ਸਿਹਤ ਲਈ ਵੀ ਅੱਛਾ ਅੱਛਾ ਹੈ ਕਿਉਂਕਿ ਇਹਦੇ ਨਾਲ ਬਹੁਤ ਘੱਟ ਬਿਮਾਰੀਆਂ ਲੱਗਦੀਆਂ ਹੈ ਕਿਉਂਕਿ ਇਹ ਨਾ ਕੋਈ ਜੀਵ ਕੋਈ ਵੀ ਨੇੜੇ ਨਹੀਂ ਆਉਂਦਾ ਹੈਗਾ ਇਸ ਕਰਕੇ ਸਾਨੂੰ ਘਰਾਂ ਵਿੱਚ ਇਸ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ